ਹਾਂਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬੀ ਨੱਚਣ ਕੁੱਦਣ ਦੇ ਬਹੁਤ ਸ਼ੋਕੀਨ ਹੁੰਦੇ ਆ ਉਹਨਾਂ ਨੂੰ ਤਾਂ ਸਿਰਫ ਮੌਕਾ ਚਾਹੀਦਾ ਹੁੰਦਾ ਬਸ ਨੱਚਣ ਦਾ ਉਚ ਵੱਧ ਚੜ ਕੇ ਹਿੱਸਾ ਲੈਂਦੇ ਆ ਜਿਵੇਂ ਹੁਣ ਮੇਰੇ ਸਾਡੇ ਕਾਲਜ ਵਿੱਚ ਕੀ ਕੁਝ ਫੈਸਟੀਵਲ ਹੁੰਦਾ ਹੈਨਾ ਉਹਦੇ ਵਿੱਚ ਕੀ ਕਿ ਸਾਡੇ ਪਿੰਡ ਦੇ ਵੀ ਸਾਡੇ ਕਾਲਜ ਵੀ ਬੱਚੇ ਵੱਧ ਚੜ ਕੇ ਹਿੱਸਾ ਲੈਂਦੇ ਆ ਬਹੁਤ ਵਧੀਆ ਪਰਫੋਰਮੈਂਸ ਤਿਆਰ ਕਰਦੇ ਬਹੁਤ ਵਧੀਆ ਮਤਲਬ ਕਿ ਮੁੰਡੇ ਕੁੜੀਆਂ ਹਨਾ ਭੰਗੜਾ ਲੁੱਟੀ ਕੁੜੀਆਂ ਦਾ ਗਿਧਾ ਬਹੁਤ ਵਧੀਆ ਹੁੰਦਾ ਤੇ ਅੱਜਕੱਲ ਮਤਲਬ ਮੇਰੇ ਸਾਡੇ ਕਾਲਜ ਦੇ ਪਿੰਡ ਦੇ ਬੱਚਿਆਂ ਦਾ ਬਹੁਤ ਇੰਟਰਸਟ ਵੱਧ ਰਿਹਾ ਆਪਣੇ ਸਪੈਸ਼ਲੀ ਕਿਹਾ ਕਿ ਆਪਣੇ ਲੋਕ ਨਾਚਾਂ ਵੱਲ ਜਿਵੇਂ ਕਿ ਭੰਗੜਾ ਲੁੱਟੀ ਗਿੱਦਾ ਸੰਮੀ ਹੈਨਾ ਇਹ ਸਾਡੇ ਪੰਜਾਬ ਦੇ ਲੋਕ ਨਾਚ ਜਿਵੇਂ ਉਹਨਾਂ ਵਿੱਚ ਬਹੁਤ ਇੰਟਰਸਟ ਲੈ ਕੇ ਪਾਰਟੀਸਪੇਟ ਕਰਦੇ ਨੇ ਸਾਡੇ ਪਿੰਡ ਦਾ ਇੱਕ ਮੁੰਡਾ ਹੈ ਜੋ ਕੀ ਬਹੁਤ ਵਧੀਆ ਭੰਗੜਾ ਪਾਉਂਦਾ ਤੇ ਉਹਨੂੰ ਉਹਨੇ ਯੂਥ ਫੈਸਟੀਵਲ ਵਿੱਚ ਪਾਰਟੀਸਪੇਟ ਕੀਤਾ ਹੈਨਾ ਉਥੇ ਵੀ ਉਹਨੂੰ ਮਤਲਬ ਫਸਟ ਪ੍ਰਾਈਜ ਮਿਲਿਆ ਬੈਸਟ ਭੰਗੜਾ ਹੋਣ ਦਾ ਪ੍ਰਾਈਜ਼ ਮਿਲਿਆ ਬੈਸਟ ਡਾਨਸਰ ਦਾ ਤੇ ਮਤਲਬ ਕਾਲਜ ਵੱਲੋਂ ਵੀ ਉਹਨੂੰ ਇੱਕਵੰਜਾ ਸੌ ਰੁਪਏ ਦਾ ਚੈੱਕ ਮਿਲਿਆ ਐਸ ਮਤਲਬ ਕਿ ਪ੍ਰਾਈਜ ਹਨਾ ਤੇ ਇੱਕ ਮਤਲਬ ਕਿ ਸਾਡੇ ਕਾਲਜ ਦੀ ਇੱਕ ਕੁੜੀ ਨੂੰ ਵੀ ਵਧੀਆ ਗਿੱਧੇ 'ਚ ਮਤਲਬ ਕਿ ਈਵਨ ਕਿ ਵੈਸੇ ਹੁਣ ਤਾਂ ਅਸੀਂ ਉਹਨੂੰ ਗਿੱਧਾ ਕੁਈਨ ਹੀ ਕਹਿੰਦੇ ਆ ਆਮ ਹੀ ਤੌਰ 'ਤੇ ਉਹਨੂੰ ਗਿੱਧਾ ਕੁਈਨ ਹੀ ਕਹਿੰਦੇ ਆ ਉਹ ਸਭ ਤੋਂ ਵਧੀਆ ਗਿੱਦਾ ਪਾਉਂਦੀ ਆ ਮਤਲਬ ਕਿ ਇੰਨਾ ਵਧੀਆ ਗਿੱਦਾ ਕਰਦੀ ਹੈ ਉਹ ਵੀ ਯੂਥ ਫੈਸਟੀਵਲਾਂ 'ਚ ਅਕਸਰ ਹੀ ਪਾਰਟੀਸਪੇਟ ਕਰਦੀ ਹੀ ਰਹਿੰਦੀ ਆ ਈਵਨ ਕਿ ਉਨ ਤਾਂ ਸਭ ਤੋਂ ਪਹਿਲ ਤੀ ਹੁੰਦੀ ਹੈ ਔਰ ਸਾਰੇ ਬੱਚੇ ਅੱਜ ਕੱਲ ਬੱਚਿਆਂ ਦਾ ਬਹੁਤ ਰੁਝਾਨ ਵੱਧ ਰਿਹਾ ਹੈ ਤੇ ਇਹ ਵਧੀਆ ਵੀ ਗੱਲ ਹੈ ਕਿ ਉਹ ਆਪਣੇ ਲੋਕ ਨਾਚਾਂ ਲੋਕ ਨਾਚਾਂ ਨੂੰ ਪ੍ਰਮੋਟ ਕਰਦੇ ਪਏ ਆ ਹਨਾ ਉਹਨਾਂ ਵੱਲ ਇੰਟਰਸਟ ਵੱਧ ਰਿਹਾ ਉਹਨਾਂ ਨੂੰ ਆਪਣੇ ਸੱਭਿਆਚਾਰ ਦਾ ਪਤਾ ਲੱਗਦਾ ਹਨਾ ਮੇਰੇ ਅਕੋਰਡਿੰਗ ਇਹ ਚੀਜ਼ ਬਹੁਤ ਵਧੀਆ ਤੇ ਮੈਨੂੰ ਬਹੁਤ ਵਧੀਆ ਵੀ ਲੱਗਦਾ ਮੈਨੂੰ ਵੀ ਬਹੁਤ ਸ਼ੌਂਕ ਆ ਯੂਥ ਫੈਸਟੀਵਲ ਵਿੱਚ ਪਾਰਟੀਸਪੇਟ ਕਰਨ ਦਾ ਹਾਂ ਸਾਡੇ ਕਾਲਜ ਵਿੱਚ ਹੁੰਦਾ ਮੈਂ ਜਰੂਰ ਕਰੂੰਗੀ ਪਾਰਟੀਸਪੇਟ